ਹਾਂਜੀ ਕੀ ਤੁਸੀਂ ਕਦੇ ਕਿਸੇ ਹਾਈਕ 'ਤੇ ਗੁਆਚੇ ਹੋ ਹਾਂ ਮੈਂ ਮੈਂ ਗੁਆਚਿਆ ਕਿਉਂਕਿ ਜਦੋਂ ਵੀ ਤੁਸੀਂ ਕਿਤੇ ਹਾਈਕ 'ਤੇ ਜਾਣਾ ਤਾਂ ਬੜੀ ਸਾਵਧਾਨੀ ਨਾਲ ਜਾਂ ਕੋਈ ਸਫ਼ਰ ਕਰ ਰਿਹਾ ਵੱਡਾ ਸਫ਼ਰ ਕਰਨਾ ਤੈਅ ਤਾਂ ਬੜੀ ਹੀ ਸਾਵਧਾਨੀ ਨਾਲ ਜਾਣਾ ਹੈ ਅਤੇ ਸੋਚ ਸਮਝ ਕੇ ਚੱਲਣਾ ਹੈ ਨਾ ਇਸੇ ਹੀ ਤਰ੍ਹਾਂ ਜਦੋਂ ਅਸੀਂ ਇੱਕ ਵਾਰ ਹਿਮਾਚਲ ਦੇ ਟੈਕਿੰਗ 'ਤੇ ਗਏ ਤਾਂ ਪਹਿਲਾਂ ਤਾਂ ਇੱਧਰੋਂ ਵੱਡਾ ਸਫ਼ਰ ਤੈਅ ਕਰਕੇ ਗਏ ਹਿਮਾਚਲ ਦਾ ਉਸ ਤੋਂ ਬਾਅਦ ਜਦੋਂ ਅਸੀਂ ਅਗਾਂਹ ਟਰੈਕਿੰਗ 'ਤੇ ਗਏ ਤਾਂ ਕਿਉਂਕਿ ਜਦੋਂ ਟਰੈਕਿੰਗ ਅਸੀਂ ਤੈਅ ਕੀਤੀ ਉੱਪਰ ਪਹਾੜ 'ਤੇ ਚੜ੍ਹੇ ਗਏ ਤਾਂ ਰਸਤੇ 'ਚ ਆਉਂਦਿਆਂ ਵੇੜੇ ਮੈਂ ਥੋੜ੍ਹਾ ਜਿਹਾ ਇੱਧਰ ਉੱਧਰ ਹੋ ਗਿਆ ਠੀਕ ਹੈ ਨਾ ਇੱਧਰ ਉੱਧਰ ਹੋਣ ਦੇ ਬਾਵਜੂਦ ਅਤੇ ਮਗਰੋਂ ਜਿਹੜੇ ਮੇਰੇ ਨਾਲ ਦੇ ਦੋਸਤ ਸੀ ਉਹ ਮੈਨੂੰ ਮੇਰੇ ਤੋਂ ਦੂਰ ਚਲੇ ਗਏ ਤਾਂ ਮੈਂ ਯਾਨੀ ਕਿ ਉੱਥੇ ਗੁਆਚ ਗਿਆ ਪੰਜਾਬੀ 'ਚ ਹਾਂਜੀ ਕਹਿ ਲਈਏ ਆਪਾਂ ਗੁਆਚ ਗਏ ਤਾਂ ਗੁਆਚਣ ਤੋਂ ਬਾਅਦ ਮੈਂ ਕੀ ਕੀਤਾ ਘਬਰਾਇਆ ਨਹੀਂ ਗਾ ਅਤੇ ਘਬਰਾਉਣਾ ਚਾਹੀਦਾ ਵੀ ਨਹੀਂ ਅਸਾਂ ਨੂੰ ਅਤੇ ਮੇਰੇ ਕੋਲ ਸੀਗਾ ਯਾਨੀ ਕਿ ਇੱਕ ਤਾਂ ਕੈਂਪਿੰਗ ਜਿਹਨੂੰ ਕਿ ਆਪਾਂ ਜਿਹਦੇ ਨਾਲ ਆਪਾਂ ਨੋਰਥ ਈਸਟ ਵਗੈਰਾ ਦੇਖ ਸਕਦੇ ਹਾਂ ਵੀ ਕਿੱਧਰ ਕਿਹੜੀ ਦਿਸ਼ਾ ਕਿੱਧਰ ਆ ਕਿਹੜੀ ਦਿਸ਼ਾ ਕਿੱਧਰ ਆ ਹਾਂ ਕਿਤੇ ਵੀ ਸਫ਼ਰ 'ਤੇ ਜਾਣਾ ਜਾਂ ਟਰੈਕਿੰਗ 'ਤੇ ਜਾਣਾ ਤਾਂ ਇਹ ਚੀਜ਼ ਜ਼ਰੂਰ ਨਾਲ ਲੈ ਕੇ ਜਾਣੀ ਆ ਨੰਬਰ ਦੋ 'ਤੇ ਮੈਪ ਮੈਪ ਮੇਰੇ ਕੋਲ ਸੀਗਾ ਜਿਸ ਦੇ ਰਸਤੇ ਮੈਂ ਨੀਚੇ ਉੱਤਰ ਆ ਸਕਦਾ ਸੀ ਅਤੇ ਆਪਣੀ ਜਗ੍ਹਾ 'ਤੇ ਆ ਸਕਦਾ ਸੀ ਉਸ ਚੀਜ਼ ਦਾ ਉਸ ਜਗ੍ਹਾ ਦਾ ਮੈਪ ਸੀ ਵੀ ਇੱਥੇ ਸਾਡਾ ਕੈਂਪ ਲੱਗਿਆ ਹੋਇਆ ਨੀਚੇ ਅਤੇ ਇੱਥੇ ਅਸੀਂ ਜਾਣਾ ਵਾ ਉਸ ਦੇ ਤਹਿ ਮੈਂ ਆਇਆ ਠੀਕ ਆ ਨਾ ਉਸ ਤੋਂ ਬਾਅਦ ਮੇਰੇ ਕੋਲ ਥੋੜ੍ਹਾ ਬਹੁਤ ਖਾਣਾ ਵੀ ਸੀਗਾ ਪੀਣ ਨੂੰ ਪਾਣੀ ਵੀ ਸੀਗਾ ਇਹ ਚੀਜ਼ਾਂ ਜ਼ਰੂਰ ਨਾਲ ਲਿਜਾਣੀਆਂ ਚਾਹੀਦੀਆਂ ਨੇ ਕਿਉਂਕਿ ਤੁਸੀਂ ਕਦੇ ਵੀ ਗੁਆਚ ਜਾਓ ਜਾਂ ਤੁਹਾਨੂੰ ਕਿਤੇ ਰਾਤ ਪੈ ਜਾਵੇ ਤਾਂ ਜੇ ਤੁਹਾਡੇ ਕੋਲ ਖਾਣ ਪੀਣ ਦੀਆਂ ਚੀਜ਼ਾਂ ਹੈਗੀਆਂ ਤਾਂ ਤੁਸੀਂ ਥੋੜ੍ਹਾ ਜਿਹਾ ਸੌਖੇ ਰਹੋਗੇ ਤੁਹਾਨੂੰ ਰਾਤ ਗੁਜ਼ਾਰਨੀ ਵੀ ਸੌਖੀ ਹੋ ਜਾਊਗੀ ਤਾਂ ਇਸੇ ਹੀ ਤਰ੍ਹਾਂ ਵੀ ਮੈਂ ਮੈਪ ਦੇ ਸਹਾਰੇ ਕੈਂਪਿੰਗ ਦੇ ਸਹਾਰੇ ਜਿਹੜਾ ਕਿ ਪਹਾੜ ਤੋਂ ਭਟਕੇ ਹੋਏ ਰਸਤੇ ਤੋਂ ਠੀਕ ਹੈ ਨਾ ਮੈਂ ਆਪਣੇ ਸਹੀ ਰਸਤੇ 'ਤੇ ਆਇਆ ਸੀਗਾ ਅਤੇ ਸਹੀ ਜਗ੍ਹਾ 'ਤੇ ਪਹੁੰਚ ਗਿਆ ਸੀਗਾ ਟੈਮ ਜ਼ਰੂਰ ਲੱਗਿਆ ਥੋੜ੍ਹਾ ਜਿਹਾ ਪਰ ਮੈਂ ਪਹੁੰਚ ਗਿਆ ਸੀਗਾ ਅਤੇ ਘਬਰਾਉਣਾ ਨਹੀਂ ਚਾਹੀਦਾ ਅਤੇ ਮੈਂ ਵੀ ਬਿਲਕੁਲ ਨਹੀਂ ਘਬਰਾਇਆ ਸੀ